ਤੈਕਨੋਲੋਜੀ ਨੇ ਫੋਟੋਗ੍ਰਾਫੀ ਖੇਤਰ ਦੇ ਵਿੱਚ ਬਹੁਤ ਹੀ ਪ੍ਰਭਾਵ ਪਾਇਆ ਹੈ ਜਿਵੇਂ ਕਿ ਅਸੀਂ ਦੇਖਦੇ ਹਾਂ ਕਿ ਪਹਿਲਾਂ ਦੇ ਜ਼ਮਾਨੇ ਦੇ ਵਿੱਚ ਟੈਕਨੋਲਜੀ ਇੰਨੀ ਜ਼ਿਆਦਾ ਉੱਪਰ ਜੇ ਖੇਤਰ ਦੇ ਨਹੀਂ ਹੀ ਬਟ ਪਰ ਹੁਣ ਟੈਕਨੋਲਜੀ ਨੇ ਆਪਣੀ ਆਪਣੀ ਛਵੀ ਦੇ ਨਾਲ ਬਹੁਤ ਹੀ ਨਵੀਂ ਕਾਢ ਕਾ ਪਾਈ ਹੈ ਜਿਸ ਦੇ ਨਾਲ ਫੋਟੋਗ੍ਰਾਫੀ ਦੇ ਖੇਤਰ ਵਿੱਚ ਬਹੁਤ ਹੀ ਵਾਧ ਪਾਈ ਗਈ ਹੈ ਜਿਵੇਂ ਕਿ ਅਸੀਂ ਪਹਿਲੇ ਇੱਕ ਫੋਟੋ ਲੈਣ ਦੇ ਲਈ ਅਸੀਂ ਰੀਲਾਂ ਦਾ ਵਰਤੋਂ ਕਰਦੇ ਹਾਂ ਜਿਹਦੇ ਲਈ ਅਸੀਂ ਰੀਲ ਵਰਤ ਵੀ ਦੇ ਲੈ ਲੈਂਦੇ ਹਾਂ ਪਟ ਪਰ ਸਾਨੂੰ ਬਹੁਤ ਸਮੇਂ ਬਾਅਦ ਜਾ ਕਰ ਪਤਾ ਲੱਗਦਾ ਸੀ ਕਿ ਫੋ ਪਰ ਫੋਟੋ ਕਿਵੇਂ ਦੀ ਆਈ ਹੈ ਜਾਂ ਕਿਵੇਂ ਦੀ ਨਹੀਂ ਪਰ ਹੁਣ ਅਸੀਂ ਟੈਕਨੋਲੋਜੀ ਦੀ ਸਹਾਇਤਾ ਨਾਲ ਨਵੀਆਂ ਕਾਢਾਂ ਨਵੀਂ ਟੈਕਨੋਲਜੀ ਜਿਵੇਂ ਕਿ ਮੋਬਾਈਲ ਫੋਨ ਅਧਿਕ ਤਰ੍ਹਾਂ ਦੇ ਕੈਮਰਿਆਂ ਤੋਂ ਅਸੀਂ ਅਲੱਗ ਅਲੱਗ ਤਰੀਕੇ ਦੀ ਤਸਵੀਰ ਲੈ ਸਕਦੇ ਹਾਂ ਅਤੇ ਉਦੋਂ ਹੀ ਨਾਲੋ ਨਾਲ ਹੀ ਦੇਖ ਕੇ ਦੱਸ ਸਕਦੇ ਹਾਂ ਕਿ ਫੋਟੋ ਕਿਵੇਂ ਦੀ ਆਈ ਹੈ ਜਾਂ ਕਿਵੇਂ ਦੀ ਅਸੀਂ ਫੋਟੋ ਖਿੱਚਣਾ ਚਾਹੁੰਦੇ ਹਾਂ ਸਾਨੂੰ ਬਹੁਤ ਹੀ ਤੈਕਨੋਲੋਜੀ ਨੇ ਫੋਟੋਗ੍ਰਾਫੀ ਦੇ ਵਿੱਚ ਇਸ ਤਰੀਕੇ ਦੀ ਖੇਤਰ ਦੇ ਵਿੱਚ ਵਾਧ ਪਾਈ ਹੈ ਅਤੇ ਉਸ ਦੇ ਨਤੀਜਿਆਂ ਦੇ ਵਿੱਚ ਸਾਨੂੰ ਬਹੁਤ ਹੀ ਜ਼ਿਆਦਾ ਮਦਦ ਕੀਤੀ ਹੈ ਟੈਕਨੋਲਜੀ ਦਾ ਫੋਟੋਗ੍ਰਾਫੀ ਖੇਤਰ ਦੇ ਵਿੱਚ ਬਹੁਤ ਹੀ ਬਲ ਬਦਲਾਅ ਲਿਆਂਦਾ ਬਹੁਤ ਹੀ ਸਹਾਇਤਾ ਕੀਤੀ ਗਈ ਹੈ